ਸਭ ਤੋਂ ਪਹਿਲਾਂ ਸਾਈਕਲ ਚਲਾਉਣ ਲਈ ਸਿਰ 'ਤੇ ਹੈਲਮਟ ਹੋਣਾ ਬਹੁਤ ਜ਼ਰੂਰੀ ਹੈ ਸਾਈਕਲ ਚਲਾਉਣ ਲੱਗੇ ਹਮੇਸ਼ਾਂ ਸੜਕ ਦੇ ਖੱਬੇ ਪਾਸੇ ਰਹਿਣਾ ਚਾਹੀਦਾ ਹੈ ਸਾਈਕਲ ਚਲਾਉਂਦੇ ਸਮੇਂ ਕਦੇ ਵੀ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਅਗਰ ਕੋਈ ਐਮਰਜੈਂਸੀ ਵਿੱਚ ਮੋਬਾਈਲ ਨਾਲ ਗੱਲ ਕਰਨੀ ਪੈਂਦੀ ਹੈ ਤਾਂ ਇੱਕ ਪਾਸੇ ਸਾਈਕਲ 'ਤੇ ਉਤਰ ਕੇ ਗੱਲ ਕਰਨੀ ਚਾਹੀਦੀ ਹੈ ਹਮੇਸ਼ਾਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਭੜਕੀਲੇ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ ਤਾਂ ਕਿ ਤੁਸੀਂ ਦੂਸਰੇ ਡਰਾਈਵਰ ਨੂੰ ਨਜ਼ਰ ਆ ਸਕੋ ਜਦੋਂ ਵੀ ਦੂਸ ਤੁਸੀਂ ਸਾਈਕਲ ਨੂੰ ਦੂਜੀ ਦਿਸ਼ਾ ਵਿੱਚ ਮੋੜਨਾ ਹੈ ਤਾਂ ਸਾਈਕਲ ਦੇ ਲੱਗੀ ਹੋਈ ਘੰਟੀ ਨੂੰ ਵਜਾਉਣਾ ਹੈ ਸਾਈਕਲ 'ਤੇ ਇੱਕ ਸਮੇਂ 'ਤੇ ਸਿਰਫ ਦੋ ਸਵਾਰੀਆਂ ਹੀ ਬੈਠ ਸਕਦੇ ਹਨ ਕਿਉਂਕਿ ਸਾਈਕਲ ਦੋ ਪਹੀਆ ਵਾਹਨ ਹੈ ਸੁਰੱਖਿਆ ਦੇ ਤੌਰ 'ਤੇ ਪਿਛਲੀ ਸਵਾਰੀ ਦੇ ਵੀ ਹੈਲਮਟ ਹੋਣਾ ਚਾਹੀਦਾ ਹੈ ਯਾਤਰਾ ਦੌਰਾਨ ਸਾਡੇ ਕੋਲ ਹਮੇਸ਼ਾਂ ਇੱਕ ਆਈ ਡੀ ਪਰੂਫ ਅਤੇ ਆਧਾਰ ਕਾਰਡ ਹੁੰਦਾ ਹੈ